ਫੋਟੋਗ੍ਰਾਫਰ ਦੀ ਭੂਮਿਕਾ ਸਮੇਂ ਦੇ ਨਾਲ ਕਾਫ਼ੀ ਬਦਲ ਗਈ ਹੈ ਖਾਸ ਕਰਕੇ ਤਕਨਾਲੋਜੀ ਵਿੱਚ ਤਰੱਕੀ ਦੇ ਨਾਲ ਪਿਛਲੇ ਸਮੇਂ ਵਿੱਚ ਫੋਟੋਗ੍ਰਾਫੀ ਇੱਕ ਵਿਸ਼ੇਸ਼ ਕਲਾ ਸੀ ਜਿਸ ਵਿੱਚ ਤਕਨੀਕੀ ਹੁਨਰ ਅਤੇ ਮਹਿੰਗੇ ਸਾਜ਼ੋ ਸਮਾਨ ਦੀ ਲੋੜ ਹੁੰਦੀ ਸੀ ਫੋਟੋਗ੍ਰਾਫਰ ਦੀ ਭੂਮਿਕਾ ਫ਼ਿਲਮ ਡਾਕ ਰੂਮ ਅਤੇ ਵਿਸ਼ੇਸ਼ ਰਚਨਾ ਨਾਲ ਜੁੜੀ ਹੋਈ ਸੀ ਪਰ ਹੁਣ ਡਿਜੀਟਲ ਕੈਮਰੇ ਸਮਾਰਟ ਫੋਨਾਂ ਅਤੇ ਚਿੱਤਰ ਸੰਪਾਦਨ ਸੋਫਟਵੇਅਰ ਦੀ ਬਦੋਲਤ ਫੋਟੋਗਰਾਫੀ ਬਹੁਤ ਜ਼ਿਆਦਾ ਪਹੁੰਚ ਯੋਗ ਹੋ ਗਈ ਹੈ ਹੁਣ ਹਰ ਕੋਈ ਸਹੀ ਆਸਾਨੀ ਨਾਲ ਫੋਟੋ ਖਿੱਚ ਸਕਦਾ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਸਕਦਾ ਹੈ ਜਿਸ ਨਾਲ ਇਹ ਖੇਤਰ ਕਾਫੀ ਮੁਕਾਬ ਤਾ ਮੁਕਾਬਲਾਤੀ ਹੋ ਗਿਆ ਹੈ ਇਸ ਦੇ ਨਤੀਜੇ ਵਜੋਂ ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਨੂੰ ਵੀ ਤਕਨਾਲੋਜੀ ਨੂੰ ਅਪਣਾਉਣ ਦੀ ਲੋੜ ਪਈ ਹੈ ਜਿਵੇਂ ਕਿ ਡਿਜੀਟਲ ਟੈਕਨਾਲੋਜੀਆਂ ਨੂੰ ਵਰਤਣਾ ਸੰਪਾਦਨ ਸੋਫਟਵੇਅਰ ਵਿੱਚ ਮਾਹਰ ਹੋਣਾ ਅਤੇ ਆਪਣੀ ਕਲਾ ਨੂੰ ਵੱਖਰਾ ਕਰਨ ਲਈ ਆਪਣੇ ਖੇਤਰ ਵਿੱਚ ਨਵੀਆਂ ਚੁਣੌਤੀਆਂ ਨੂੰ ਲੈ ਕੇ ਆਉਣਾ